ਹੈਲੋ ਹਾਂਜੀ ਠੀਕ ਹੈ ਜੀ ਤੁਸੀਂ ਸੁਣਾਓ ਕੁਲਜੀਤ ਜੀ ਕੀ ਹਾਲ ਆ ਹੋਰ ਘਰ ਪਰਿਵਾਰ ਕਿਵੇਂ ਸਾਰੇ ਬਸ ਵਧੀਆ ਜੀ ਠੀਕ ਹੈ ਜੀ ਓਕੇ ਓਕੇ ਆਪਣਾ ਫਰੀਦਕੋਟ ਆਇਆ ਘੁੰਮਣ ਵਾਸਤੇ ਉਹ ਠੀਕ ਹੈ ਜੀ ਠੀਕ ਹੈ ਠੀਕ ਹੈ ਹਾਂਜੀ ਆਪਣੇ ਇੱਥੇ ਫਰੀਦਕੋਟ ਬਹੁਤ ਥਾਵਾਂ ਹਿਸਟੋਰੀਕਲ ਥਾਵਾਂ ਬਹੁਤ ਨੇ ਜਿੱਦਾਂ ਕਿ ਆਪਣਾ ਬਾਬਾ ਫਰੀਦ ਜੀ ਦਾ ਟਿੱਲਾ ਹੈਗਾ ਆਪਣੇ ਮਾਈ ਕੋਲਰੀ ਸਾਹਿਬ ਹੋ ਗਿਆ ਹੈ ਨਾ ਗੁਰਦੁਆਰਾ ਬਹੁਤ ਸੋਹਣਾ ਬਣਿਆ ਉੱਥੇ ਵੀ ਹਾਂਜੀ ਅਤੇ ਸਭ ਤੋਂ ਵੱਡੀ ਚੀਜ਼ ਆਪਣੇ ਕਿਲ੍ਹਾ ਰਾਜਾ ਰਾਜੇ ਦਾ ਕਿਲ੍ਹਾ ਫਰੀਦਕੋਟ ਦੇ ਰਾਜੇ ਦਾ ਕਿਲ੍ਹਾ ਇਹ ਚੀਜ਼ਾਂ ਬਹੁਤ ਘੁੰਮਣ ਵਾਲੀਆਂ ਅੰਦਰੋਂ ਬਹੁਤ ਵਧੀਆ ਸ਼ਾਨਦਾਰ ਬਣੀਆਂ ਹੋਈਆਂ ਸਾਰੀਆਂ ਹਾਂਜੀ ਹਾਂਜੀ ਐਂਟਰੀ ਹੈਗੀ ਹੈ ਸਾਰੇ ਕਿਤੇ ਆਪਣੇ ਦਿਨੇ ਦਿਨੇ ਜਿੱਥੇ ਮਰਜ਼ੀ ਜਾਓ ਬਾਬਾ ਫਰੀਦ ਹੋ ਗਿਆ ਆਪਣੇ ਮਾਈ ਗੋਡੀ ਸਾਹਿਬ ਹੋ ਗਿਆ ਹੈ ਨਾ ਇੱਧਰ ਆਪਣਾ ਕਿਲ੍ਹਾ ਵੀ ਆਪਣੇ ਇੱਥੇ ਮਾਰਕੀਟ ਬਹੁਤ ਵਧੀਆ ਬਣੀ ਹੋਈ ਆ ਹਾਂ ਜੀ ਹਾਂਜੀ ਉਹ ਮਸ਼ਹੂਰ ਆ ਤੁਹਾਨੂੰ ਪਤਾ ਹੀ ਆ

ਹਾਂ ਸਪੈਸ਼ਲ ਤਾਂ ਫਿਰ ਉਹਨਾਂ ਨੂੰ ਜ਼ਰੂਰ ਬਾਬਾ ਫਰੀਦ ਲੈ ਕੇ ਜਾਓ ਜੇ ਕਿਉਂਕਿ ਤੁਹਾਨੂੰ ਪਤਾ ਗਾ ਆਪਣਾ ਜਿਹੜਾ ਇਤਿਹਾਸ ਜ਼ਿਆਦਾਤਰ ਬਾਬਾ ਫਰੀਦ ਜੀ ਕਰਕੇ ਹੀ ਬਣਿਆ ਇੱਥੇ ਫਰੀਦਕੋਟ ਦਾ ਹਾਂਜੀ ਬਾਕੀ ਤੁਸੀਂ ਥੋੜ੍ਹਾ ਬਹੁਤਾ ਜੇ ਬੱਚਿਆਂ ਦਾ ਮਨੋਰੰਜਨ ਲਈ ਵੀ ਤੁਸੀਂ ਰੈਸਟ ਹਾਊਸ ਜਾ ਸਕਦੇ ਆਪਣੇ ਫਰੀਦਕੋਟ ਵਿੱਚ ਹਾਂ ਅਤੇ ਝੂਲੇ ਵਗੈਰਾ ਬਹੁਤ ਸੋਹਣਾ ਪਾਰਕ ਬਣਿਆ ਹੋਇਆ ਬੱਚਿਆਂ ਲਈ ਖੇਡਣ ਲਈ ਹਾਂ ਛੋਟੇ ਛੋਟੇ ਬੱਚਿਆਂ ਲਈ ਨਾ ਝੂਲੇ ਵਗੈਰਾ ਬਹੁਤ ਸੇਫ ਛੋਟੇ ਛੋਟੇ ਜਿਹਨਾਂ ਕਰਕੇ ਵੀ ਮਨੋਰੰਜਨ ਹੋ ਜਾਊ ਬੱਚਿਆਂ ਦਾ ਹਾਂਜੀ ਅਤੇ ਹਾਂਜੀ ਜ਼ਰੂਰ ਹਾਂਜੀ ਜ਼ਰੂਰ ਆਪਾਂ ਉਹਨਾਂ ਨੂੰ ਕੋਈ ਨਾ ਸਾਰਾ ਜਿਹੜਾ ਆਪਣਾ ਸ਼ਹਿਰ ਆ ਪੂਰਾ ਘੁਮਾ ਦਵਾਂਗੇ ਹੁਣ ਤਾਂ ਆਪਣੇ ਹੋਰ ਗੱਲ ਸੁਣੋ ਤੁਸੀਂ ਵੀ ਸ਼ਾਇਦ ਹੋ ਸਕਦਾ ਉਹ ਮਾੜਾ ਮੋਟਾ ਖਾਣ ਪੀਣ ਦੇ ਵੀ ਸ਼ੌਕੀਨ ਹੋ ਆਪਣੇ ਬਹੁਤ ਸੋਹਣੇ ਇੱਥੇ ਹੋਟਲ ਵੀ ਖੁੱਲ੍ਹ ਚੁੱਕੇ ਆ ਹੁਣ ਤਾਂ ਕਿਉਂਕਿ ਬਾਹਰੋਂ ਆਏ ਆ ਹੁਣ ਉਹ ਉਹਨਾਂ ਨੂੰ ਰੋਟੀ ਪਾਣੀ ਦੀ ਵੀ ਇੱਥੇ ਵਧੀਆ ਆਪਣੇ ਸਾਰਾ ਕੁਝ ਹੋਟਲ ਬਹੁਤ ਸੋਹਣੇ ਖੁੱਲ੍ਹੇ ਹੋਏ ਆ ਇਸੇ ਰੋਡ 'ਤੇ ਓਕੇ ਓਕੇ ਹਾਂ ਬਹੁਤ ਵਧੀਆ ਜੀ ਬਹੁਤ ਵਧੀਆ ਸਹੀ ਗੱਲ ਆ ਪਰ ਉਹਨਾਂ ਨੂੰ ਉੱਥੇ ਕਿੱਥੇ ਖਾਣ ਨੂੰ ਮਿਲਣਾ ਇੱਥੇ ਹੀ ਮਿਲਣਾ ਫਰੀਦਕੋਟ ਪੰਜਾਬ 'ਚ ਨਹੀਂ ਆਪਣਾ ਹੈਗਾ ਬਰਜਿੰਦਰਾ ਕਾਲਜ ਜੀ ਫੇਮਸ ਸਭ ਤੋਂ ਇਹ ਸਾਰੀਆਂ ਚੀਜ਼ਾਂ ਇਹ ਰਾਜੇ ਦੇ ਵੇਲੇ ਦੀਆਂ ਰਾਜੇ ਦੀਆਂ ਖੜ੍ਹੀਆਂ ਕੀਤੀਆਂ ਹੋਈਆਂ ਚੀਜ਼ਾਂ ਇਹ ਜਿਵੇਂ ਆਪਣਾ ਰੈਸਟ ਹਾਊਸ ਹੋ ਗਿਆ ਬਰਜਿੰਦਰਾ ਕਾਲਜ ਹੋ ਗਿਆ ਹੋਸਪਿਟਲ ਆਪਣਾ ਸਭ ਤੋਂ ਜਿਹੜਾ ਮਸ਼ਹੂਰ ਹੈ ਨਾ ਬਾਬਾ ਫਰੀਦ ਜੀ ਦੇ ਨਾਮ 'ਤੇ ਆਪਣਾ ਮੈਡੀਕਲ ਵੱਡਾ ਠੀਕ ਹੈ ਜੀ ਸਾਰੀਆਂ ਰਾਜੇ ਦੀਆਂ ਖੋਲ੍ਹੀਆਂ ਹੋਈਆਂ ਚੀਜ਼ਾਂ ਨੇ ਬਾਕੀ ਕੋਈ ਨਾ ਤੁਸੀਂ ਜਦੋਂ ਆਏ ਹੋ ਆਪਾਂ ਉਹਨਾਂ ਨੂੰ ਕੋਈ ਨਾ ਸਾਰਾ ਜਿਹੜਾ ਜਾਣਕਾਰੀ ਦਵਾਂਗੇ ਨਾਲੇ ਨਾਲ ਨਾਲ ਉਹਨਾਂ ਨੂੰ ਦਿਖਾਵਾਂਗੇ ਤੁਸੀਂ ਕੋਈ ਨਾ ਕਾਲ ਕਰ ਲਿਓ ਜੀ ਠੀਕ ਹੈ ਜੀ